ਸਮਾਰਟ ਫੋਨ ਜੋ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਬਣੀ ਹੋਈ ਹੈ ਇਸ ਨੇ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਹੈ ਇਹ ਕਈ ਤਰੀਕੇ ਦੇ ਨਾਲ ਸਾਡੀ ਮਦਦਗਾਰ ਸਾਬਤ ਹੋਏ ਹਨ ਜਿਵੇਂ ਕਿ ਸਾਡੇ ਕੋਲ ਸਾਡੇ ਕੰਟੈਕਟਸ ਦੇ ਵਿੱਚ ਬਾਕੀ ਸਾਰਿਆਂ ਦੇ ਨੰਬਰ ਹੁੰਦੇ ਹਨ ਤੁਸੀਂ ਇੱਥੇ ਬੈਠੇ ਹੀ ਸੰਸਾਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਬੰਦੇ ਦੇ ਨਾਲ ਗੱਲ ਕਰ ਸਕਦੇ ਹੋ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹੋ ਤੁਹਾਨੂੰ ਆਪਣਾ ਅਤੇ ਦੂਸਰੇ ਦੇ ਨਾਲ ਜਿਹੜੀ ਕੋਈ ਵੀ ਜਾਣਕਾਰੀ ਅਦਾਨ ਪ੍ਰਦਾਨ ਤੁਸੀਂ ਕਰ ਸਕਦੇ ਹੋ ਇਸੇ ਦੇ ਨਾਲ ਹੀ ਜਿਹੜੇ ਸਮਾਰਟ ਫੋਨ ਨੇ ਉਹ ਅਲਾਰਮ ਦਾ ਕੰਮ ਵੀ ਕਰਦੇ ਹਨ ਤੁਹਾਨੂੰ ਘੜੀ ਦੇਖਣ ਦੀ ਜ਼ਰੂਰਤ ਨਹੀਂ ਸਮਾਂ ਹਮੇਸ਼ਾਂ ਹੀ ਤੁਹਾਡੇ ਫੋਨ ਦੇ ਉੱਪਰ ਤੁਹਾਨੂੰ ਦੱਸਦਾ ਰਹੇਗਾ ਅਗਰ ਤੁਸੀਂ ਸਮੇਂ ਕਿਹੜੇ ਸਮੇਂ ਉੱਪਰ ਉੱਠਣਾ ਹੈ ਤੁਸੀਂ ਕਿਹੜੇ ਸਮੇਂ ਉੱਪਰ ਸੌਣਾ ਹੈ ਇਸ ਦਾ ਵੀ ਤੁਸੀਂ ਅਲਾਰਮ ਸੈੱਟ ਕਰ ਸਕਦੇ ਹੋ ਅਗਰ ਤੁਹਾਡੇ ਸਮਾਰਟ ਫੋਨ ਦੇ ਵਿੱਚ ਇੰਟਰਨੈਟ ਦੇ ਜ਼ਰੀਏ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਹਾਸਿਲ ਕਰ ਸਕਦੇ ਹੋ ਕਿਸੇ ਵੀ ਪੱਖ ਦੀ ਜਾਣਕਾਰੀ ਚਾਹੇ ਉਹ ਤੁਹਾਡੀ ਖੇਡਾਂ ਨਾਲ ਸੰਬੰਧਿਤ ਹੈ ਚਾਹੇ ਉਹ ਤੁਹਾਡੇ ਐਜੂਕੇਸ਼ਨ ਨਾਲ ਸੰਬੰਧਿਤ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਅ ਸਮਾਰਟ ਫੋਨ ਅਤੇ ਇੰਟਰਨੈਟ ਦੇ ਜ਼ਰੀਏ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹੋ ਫੋਨਾਂ ਦੇ ਵਿੱਚ ਇੱਕ ਬਹੁਤ ਹੀ ਅੱਛਾ ਫੀਚਰ ਰੀਮਾਈਂਡਰ ਵੀ ਹੈ ਅਗਰ ਕਿਸੇ ਦਾ ਜਨਮ ਤਰੀਕ ਅਗਰ ਕਿਸੇ ਦੇ ਬਰਥਡੇ ਜਾਂ ਫਿਰ ਕੋਈ ਵੀ ਤਰ੍ਹਾਂ ਦਾ ਓਕੇਜ਼ਨ ਹੈ ਵੈਡਿੰਗ ਐਨਿਵਰਸਰੀ ਹੈ ਤਾਂ ਤੁਸੀਂ ਉਸ ਦੀ ਡੇਟ ਜਿਹੜੀ ਜਾਂ ਕੋਈ ਵੀ ਤੁਹਾਡਾ ਕੋਈ ਯਾਦ ਰੱਖਣ ਯੋਗ ਕੋਈ ਤਰੀਕ ਹੈ ਤਾਂ ਤੁਸੀਂ ਉਹਨੂੰ ਰੀਮਾਈਂਡਰ ਦੇ ਵਿੱਚ ਪਾ ਸਕਦੇ ਹੋ ਇਹ ਤੁਹਾਨੂੰ ਐਜ ਆ ਨੋਟਬੁੱਕ ਵੀ ਕੰਮ ਕਰਦਾ ਹੈ ਤੁਸੀਂ ਇਹਦੇ ਵਿੱਚ ਆਪਣੇ ਜ਼ਰੂਰੀ ਗੱਲਾਂ ਨੋਟ ਕਰ ਸਕਦੇ ਹੋ ਅਤੇ ਸਮਾਂ ਆਉਣ ਦੇ ਉੱਪਰ ਤੁਸੀਂ ਉਸ ਨੂੰ ਚੈੱਕ ਵੀ ਕਰ ਸਕਦੇ ਹੋ ਇਹ ਕੈਲਕੂਲੇਟਰ ਦਾ ਕੰਮ ਵੀ ਕਰਦਾ ਹੈ ਤੁਸੀਂ ਜੋੜ ਘਟੋ ਕਰਨ ਦੇ ਲਈ ਹੁਣ ਤੁਹਾਨੂੰ ਅਲੱਗ ਤੋਂ ਕੈਲਕੂਲੇਟਰ ਚੱਕਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਫੋਨ ਦੇ ਵਿੱਚ ਹੀ ਇਹ ਸੁਵਿਧਾ ਪ੍ਰਾਪਤ ਹੈ ਤਾਂ ਤੁਹਾਨੂੰ ਫੋਨ ਇੱਕ ਫੋਨ ਜੇ ਸਿਰਫ ਤੇ ਸਿਰਫ ਇੱਕ ਦੂਜੇ ਨਾਲ ਗੱਲ ਕਰਨ ਦਾ ਜ਼ਰੀਆ ਹੀ ਨਹੀਂ ਰਹਿ ਗਿਆ ਇਹਦੇ ਵਿੱਚ ਇੰਨੇ ਕੁ ਫੀਚਰਸ ਨੇ ਇੰਨੀਆਂ ਕੁ ਐਪਸ ਨੇ ਕਿ ਤੁਸੀਂ ਆਪਣੀ ਜ਼ਰੂਰਤ ਅਤੇ ਤਵੱਜੋ ਦੇ ਹਿਸਾਬ ਦੇ ਨਾਲ ਉਹ ਐਪਸ ਡਾਊਨਲੋਡ ਕਰ ਸਕਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਉਸ ਫੋਨ ਤੋਂ ਹੋਰ ਵੀ ਬਹੁਤ ਸਾਰੇ ਕੰਮ ਲੈ ਸਕਦੇ ਹੋ